ਹਾਂਜੀ ਪਹਿਲੇ ਜਮਾਨੇ ਦੇ ਵਿੱਚ ਅਸੀਂ ਖੇਡਦੇ ਸੀ ਸਾਨੂੰ ਪਿਛਲੀਆਂ ਜਿਹੜੀਆਂ ਗੱਲਾਂ ਹੈ ਸੀ ਖੇਡਾਂ ਸੀ ਉਹ ਬਹੁਤ ਪਸੰਦ ਆਉਂਦੀਆਂ ਸੀ ਹ ਅੱਜ ਕੱਲ੍ਹ ਦੇ ਵਿੱਚ ਤਾਂ ਕੋਈ ਇੱਕ ਦੂਜੇ ਦੇ ਕੋਲ ਬਹਿ ਕੇ ਵੀ ਠੀਕ ਨਹੀਂ ਸਮਝਦੇ ਹੈ ਅਤੇ ਸਾਨੂੰ ਨ ਲੋਕ ਨਾਚ ਹੁੰਦਾ ਸੀ ਬੜਾ ਕੁਛ ਕਰਦੇ ਸੀ ਦੁਨੀਆਂ ਬੱਚੇ ਬਹੁਤ ਖੇਡਾਂ ਖੇਡਦੇ ਸੀ ਹੈਂ ਉਹ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਸੀ ਹੈਂ ਅਸੀਂ ਉਨ੍ਹਾਂ ਨਾਲ ਆ ਕੇ ਬਹਿੰਦੇ ਸੀ ਦੇਖਦੇ ਹੀ ਖੁਸ਼ ਹੁੰਦੇ ਸੀ ਬਹੁਤ ਪਿਆਰੇ ਬੱਚੇ ਲੱਗਦੇ ਸੀ ਪਿਆਰੀਆਂ ਲੜਕੀਆਂ ਲੱਗਦੀਆਂ ਸੀ ਲੜਕੇ ਲੱਗਦੇ ਸੀ ਅਸੀਂ ਉਨ੍ਹਾਂ ਨਾਲ ਬਹੁਤ ਖੇਡਦੇ ਸੀ ਅੱਛਾ ਮੰਦਰਾਂ 'ਚ ਜਾਂਦੇ ਸੀ ਕੀਰਤਨ ਮ ਮੰਡਲੀਆਂ ਲੈ ਕੇ ਜਾਂਦੇ ਸੀ ਉੱਥੇ ਵੀ ਸਾਨੂੰ ਬੜਾ ਮਜਾ ਆਉਂਦਾ ਸੀ ਅਸੀਂ ਭਗਵਾਨ ਦਾ ਨਾਮ ਲੈਂਦੇ ਸੀ ਨਾਚ ਟਾਪ ਖੂਬ ਹੁੰਦਾ ਸੀ ਹੈਂ ਫਿਰ ਅਸੀਂ ਰਾਮਲੀਲਾ ਹੁੰਦੀ ਸੀ ਉਹ ਵੀ ਦੇਖਦੇ ਸੀ ਹੈਂ ਫਿਰ ਅਸੀਂ ਉਹ ਕਰਦੇ ਸੀ ਮੰਦਰਾਂ 'ਚ ਜਾ ਕੇ ਹਵਨ ਕਰਦੇ ਸੀ ਅੱਜ ਕੱਲ੍ਹ ਤਾਂ ਕੁਛ ਨਹੀਂ ਸਭ ਕੁਛ ਬੰਦ ਹੋ ਜਾਏ ਹੋ ਹੋ ਗਿਆ ਹੈ ਹੈਂ